ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ

ਠੀਕ ਹੈ ਜੀ ਕਿਹੜੀ ਥਾਂ ਤੋਂ ਜੀ ਕਿਹੜੇ ਥਾਂ ਤੋਂ ਜੀ ਰਾਜਸਥਾਨ ਤੋਂ ਹਾਂ ਜੀ ਹਾਂਜੀ

ਬਿਲਕੁਲ ਕਰਾ ਦਾਂਗੇ ਜੀ ਕਿੰਨੇ ਮੈਂਬਰ ਹੋ ਜੀ ਤੁਸੀਂ ਜਾਣ ਵਾਲੇ ਜਾਣ ਵਾਲੇ ਘੁੰਮਣ ਵਾਲੇ ਕਿੰਨੇ ਮੈਂਬਰ ਹੋ ਜੀ ਚਾਰ ਮੈਂਬਰ ਹੋ ਜੀ ਹਾਂਜੀ ਘੁਮਾ ਦਿਆਂਗੇ ਜੀ ਕਿੱਥੇ ਜਾਣਾ ਚਾਹੋਗੇ ਜੀ ਪੈਦਲ ਘੁੰਮਣਾ ਚਾਹੋਗੇ ਜਾਂ ਉੱਥੇ ਸਾਡੇ ਵਹੀਕਲ ਸਾਡੇ ਜਿਹੜੇ ਹੈਗੇ ਆ ਉਹਨਾਂ ਦੀ ਸਹਾਇਤਾ ਲੈਣੀ ਚਾਹੋਗੇ ਜਿਵੇਂ ਤੁਸੀਂ ਕਹੋਗੇ ਅਸੀਂ ਉਸ ਤਰੀਕੇ ਨਾਲ ਹੀ ਤੁਹਾਨੂੰ ਜਿਹੜਾ ਹੋਲਾ ਮਹੱਲਾ ਉਹ ਵਿਖਾ ਦਿਆਂਗੇ ਸਾਡੇ ਕੋਲ ਉੱਥੇ ਜਿਵੇਂ ਮਨ ਲਓ ਜਿਹੜੀ ਆਪਾਂ ਡੇਸਟੀਨੈਸ਼ਨ 'ਤੇ ਪਹੁੰਚਣਾ ਲੋਕੇਸ਼ਨ 'ਤੇ ਪਹੁੰਚ ਕੇ ਉੱਥੇ ਸਾਡੇ ਕੋਲ ਸਾਡੇ ਆਪਣੇ ਪਰਸਨਲ ਬਾਈਕਸ ਹੈਗੇ ਆ ਫ਼ੋਰ ਵਹੀਲਰ ਉੱਥੇ ਪਹੁੰਚਣ ਲਈ ਸਾਡੇ ਕੋਲ ਟੈਕਸਿਜ ਹੈਗੀਆਂ ਫੋਰ ਸੀਟੇਡ ਫਾਈਵ ਸੀਟੇਡ ਕੈਬ ਹੈਗੀਆਂ ਸਾਡੇ ਕੋਲ ਜਿਹੜੀਆਂ ਸਾਡੀਆਂ ਚੱਲਦੀਆਂ ਰੁਟੀਨ 'ਚ ਠੀਕ ਹੈ ਉੱਥੇ ਤੁਹਾਨੂੰ ਠੀਕ ਹੈ ਜੀ ਕੈਬ ਬੁੱਕ ਕਰਵਾ ਦਿਆ ਤੁਹਾਨੂੰ ਅਤੇ ਤੁਸੀਂ ਆ ਜਿਓ ਤੁਹਾਨੂੰ ਪੰਜਾਬ ਦਾ ਜਿਹੜਾ ਹੋਲਾ ਮਹੱਲਾ ਹੈ ਉਹ ਅਸੀਂ ਵਿਜ਼ਿਟ ਕਰਾ ਦਿਆਂਗੇ ਹਾਂ ਹਾਂ ਉੱਥੋਂ ਇਸ ਤੋਂ ਇਲਾਵਾ ਸਾਡੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਅਤੇ ਇਸ ਤੋਂ ਇਲਾਵਾ ਸਾਡੇ ਅੰਮ੍ਰਿਤਸਰ ਦੇ ਵਿੱਚ ਜ਼ਿਲ੍ਹਿਆਂ ਵਾਲਾ ਬਾਗ ਜਿਹੜਾ ਕਿ ਬਹੁਤ ਮਸ਼ਹੂਰ ਹੈ ਉੱਨੀ ਸੌ ਉੱਨੀ ਦੇ ਵਿੱਚ ਜਿਹੜਾ ਦਹਾਕਾ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਕਾਫੀ ਉੱਥੇ ਸੁਣਨ ਨੂੰ ਦੇਖਣ ਨੂੰ ਉਸ ਤੋਂ ਇਲਾਵਾ ਹੋਰ ਵੀ ਕਾਫੀ ਜਿਹੜੇ ਹੈਗੇ ਹੈ ਤੁਸੀਂ ਦੇਖ ਜੋ ਆਪਣੇ ਗੁਰਦੁਆਰਾ ਸਾਹਿਬ ਘੁੰਮਣਾ ਚਾਹੁੰਦੇ ਹੋ ਤਾਂ ਉਹ ਘੁੰਮਾਵਾਂਗੇ ਤੁਹਾਨੂੰ ਤੁਹਾਨੂੰ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਦਿੱਕਤ ਜਾਂ ਪਰੇਸ਼ਾਨੀ ਨਹੀ ਹੋਏਗੀ